ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਸੱਭਿਆਚਾਰਕ ਅਤੇ ਸਮਾਜਿਕ ਅੰਤਰ ਪਾਏ ਜਾਂਦੇ ਹਨ ਜਿਵੇਂ ਮੰਨ ਲਉ ਪੰਜਾਬ ਦੇ ਵੱਖ ਵੱਖ ਖੇਤਰ ਜਗ੍ਹਾ ਆਪਾਂ ਵੱਖਰੀ ਵੱਖਰੀ ਲੈ ਲੈਂਦੇ ਹਾਂ ਕੋਈ ਸ਼ਹਿਰਾਂ ਦੇ ਨਾਂ ਲੈ ਲੈਂਦੇ ਹਾਂ ਜਾਂ ਪੇਂਡੂ ਖੇਤਰਾਂ ਦੇ ਹੀ ਨਾਂ ਲੈ ਲੈਂਦੇ ਹਾਂ ਉਹਨਾਂ ਵਿੱਚ ਸਮਾਜਿਕ ਅੰਤਰ ਵੀ ਪਾਇਆ ਜਾਂਦਾ ਹੈ ਅਤੇ ਸੱਭਿਆਚਾਰਕ ਅੰਤਰ ਵੀ ਪਾਇਆ ਜਾਂਦਾ ਹੈ ਪਿੰਡਾਂ ਦੇ ਵਿੱਚ ਜਿਹੜਾ ਆਪਣਾ ਮੇਨ ਕਲਚਰ ਹੈ ਪੰਜਾਬ ਦਾ ਉਹਦਾ ਸੱਭਿਆਚਾਰ ਅਤੇ ਸਮਾਜਿਕ ਸੋਚ ਜਿਹੜੀ ਹੈ ਉਹ ਸ਼ਹਿਰਾਂ ਦੇ ਮੁਕਾਬਲੇ ਥੋੜ੍ਹੀ ਫਰਕ ਨਾਲ ਹੈ ਥੋੜ੍ਹੀ ਨਹੀਂ ਕਹਿ ਸਕਦੇ ਕਿ ਕਾਫੀ ਫਰਕ ਨਾਲ ਹੈ ਪਿੰਡਾਂ ਦੇ ਲੋਕਾਂ ਦੀ ਸੋਚ ਜਿਹੜੀ ਹੈ ਉਹ ਪੁਰਾਤਨ ਬਜ਼ੁਰਗਾਂ ਦੇ ਕਹਿਣੇ 'ਤੇ ਚੱਲਦੀ ਹੈ ਜਦਕਿ ਸ਼ਹਿਰਾਂ ਵਿੱਚ ਲੋਕ ਆਪਣੀ ਮਰਜ਼ੀ ਨਾਲ ਚੱਲਦੇ ਨੇ ਉਹਨਾਂ ਦੇ ਤਿਉਹਾਰ ਜਿਵੇਂ ਆਪਣੇ ਪੰਜਾਬ ਦੇ ਵਿੱਚ ਵੱਖਰੇ ਵੱਖਰੇ ਲੈ ਲਈਏ ਸ਼ਹਿਰ ਜਿਵੇਂ ਮਾਝੇ ਮਾਲਵੇ ਦੇ ਤਿਉਹਾਰ ਹੋਰ ਨੇ ਫਿਰੋਜ਼ਪੁਰ ਮੋਗਾ ਔਰ ਅੰਮ੍ਰਿਤਸਰ ਤਰਨ ਤਾਰਨ ਦੇ ਤਿਉਹਾਰ ਜਿਹੜੇ ਨੇ ਉਹ ਹੋਰ ਨੇ ਲੋਕਲ ਫੈਸਟੀਵਲ ਜਿਹਨੂੰ ਆਪਾਂ ਕਹਿੰਦੇ ਹਾਂ ਜਾਂ ਬਿਹੇਵੀਅਰ ਉਹਨਾਂ ਦਾ ਵੱਖਰਾ ਵੱਖਰਾ ਹੁੰਦਾ ਆ ਜਿਵੇਂ ਮਾਝੇ ਦੇ ਲੋਕ ਜਿਹੜੇ ਕੁਝ ਸਖਤ ਸੁਭਾਅ ਦੇ ਗਿਣੇ ਜਾਂਦੇ ਨੇ ਕੁਛ ਲੜਾਕੇ ਗੁੱਸੇ ਵਾਲੇ ਹੌਸਲੇ ਵਾਲੇ ਅਣਖ ਵਾਲੇ ਉਹਨਾਂ ਦੇ ਮੁਕਾਬਲੇ ਜਿਵੇਂ ਮਾਲਵੇ ਦੇ ਲੋਕ ਹੈ ਦੁਆਬੇ ਦੇ ਲੋਕ ਨੇ ਉਹ ਥੋੜ੍ਹੇ ਜਿਹੇ ਨਰਮ ਦਿਲ ਸਮਝੇ ਜਾਂਦੇ ਨੇ ਜਿਵੇਂ ਪੰਜਾਬੀ ਵਿੱਚ ਕਹਾਵਤ ਹੈ ਬੜੀ ਪੁਰਾਣੀ ਕਿ ਬਜ਼ੁਰਗਾਂ ਦੇ ਤੱਤ ਨਿਕਲੇ ਨੇ ਕਿ ਮਾਝੇ ਦਾ ਸ਼ਰੀਫ ਔਰ ਦੁਆਬੇ ਦਾ ਬਦਮਾਸ਼ ਇੱਕ ਬਰਾਬਰ ਨੇ ਸੋ ਇਹ ਜਿਹੜੇ ਬਿਹੇਵੀਅਰ ਹੈ ਇਹ ਸਾਨੂੰ ਉਸ ਪ੍ਰਾਂਤ ਦੀ ਜਾਂ ਉਸ ਖੇਤਰ ਦੀ ਉਹ ਸਾਰੀ ਦੱਸਦੇ ਨੇ ਡਿਟੇਲ ਦਿੰਦੇ ਨੇ ਕਿ ਉੱਥੋਂ ਦੇ ਲੋਕ ਕਿਹੋ ਜਿਹੇ ਨੇ